ਤੇਰਾਂ ਦੋ ਹਜ਼ਾਰ ਚਾਰ ਸੌ ਚੁਤਾਲੀ ਇੱਕ ਹਜ਼ਾਰ ਪੰਜ ਸੌ ਚੁਰਾਸੀ ਤੀਹ ਹਜ਼ਾਰ ਅੱਠ ਸੌ ਉਣੰਜਾ ਦਸ ਹਜ਼ਾਰ ਨੌ ਸੌ ਤ੍ਰੇਹਠ